ਅਸੀਂ ਧਾਰਮਿਕ ਤਿਉਹਾਰ ਨੂੰ ਆਪਣੇ ਹੀ ਤਰੀਕੇ ਨਾਲ ਮਨਾਉਂਦੇ ਹਾਂ ਸਭ ਤੋਂ ਪਹਿਲੇ ਸਵੇਰੇ ਸਾਰਾ ਪਰਿਵਾਰ ਸੁਵਖਤੇ ਹੀ ਉੱਠ ਕੇ ਇਸ਼ਨਾਨ ਕਰਦੇ ਹਾਂ ਫਿਰ ਆਪਾਂ ਅਸੀਂ ਗੁਰਦੁਆਰੇ ਮੱਥਾ ਟੇਕਣ ਜਾਂਦੇ ਹਾਂ ਪਾਠ ਕਰ ਕਰਦੇ ਹਾਂ ਫਿਰ ਘਰ ਆ ਕੇ ਘਰ ਦੇ ਕੰਮ ਸਮੇਟ ਕੇ ਰੋਟੀ ਪਾਣੀ ਖਾਂਦੇ ਹਾਂ ਸ਼ਾਮ ਦੇ ਵੇਲੇ ਅਸੀਂ ਸਾਰੇ ਮੁਹੱਲੇ ਵਾਲੇ ਇਕੱਠੇ ਹੁੰਦੇ ਹਾਂ ਆਪਣੇ ਮੁਹੱਲੇ ਵਿੱਚ ਹੀ ਅਸੀਂ ਉਸ ਤਿਉਹਾਰ ਨੂੰ ਰਲ ਮਿਲ ਕੇ ਮਨਾਉਂਦੇ ਹਾਂ ਸਾਂਝੇ ਤੌਰ 'ਤੇ ਕੰਟਰੀਬਿਊਸ਼ਨ ਕਰ ਲੈਂਦੇ ਹਾਂ ਫਿਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਅਸੀਂ ਆਪਣੇ ਆਪਣੇ ਘਰਾਂ ਵਿੱਚੋਂ ਕੁਝ ਸਮਾਨ ਬਣਾ ਕੇ ਉੱਥੇ ਲੈ ਜਾਂਦੇ ਹਾਂ ਗਲੀ ਮੁਹੱਲੇ ਵਿੱਚ ਕਨਾਤਾਂ ਲਾ ਕੇ ਟੈਂਟ ਲਾ ਕੇ ਅਸੀਂ ਸੋਹਣੀ ਤਰ੍ਹਾਂ ਤਿਉਹਾਰ ਨੂੰ ਮਨਾਉਂਦੇ ਹਾਂ ਵਨ ਵੰਨ ਸਵੰਨੇ ਭੋਜਨ ਇਕੱਠੇ ਹੋ ਜਾਂਦੇ ਹਨ ਕੋਈ ਕੜਾਹ ਪ੍ਰਸ਼ਾਦ ਬਣਾ ਕੇ ਲਿਆਉਂਦਾ ਹੈ ਕੋਈ ਫੁਲਕੇ ਲਿਆਉਂਦਾ ਹੈ ਕੋਈ ਸਬਜ਼ੀਆਂ ਲਿਆਉਂਦਾ ਹੈ ਕੋਈ ਚਾਹ ਬਣਾ ਕੇ ਲਿਆਉਂਦਾ ਹੈ ਇਸ ਤਰ੍ਹਾਂ ਸਾਨੂੰ ਰਲ ਮਿਲ ਕੇ ਥੋੜ੍ਹਾ ਥੋੜ੍ਹਾ ਭਾਰ ਸਾਡੇ 'ਤੇ ਪੈਂਦਾ ਹੈ ਫਿਰ ਅਸੀਂ ਸਾਡੇ ਕੋਲ ਬਹੁਤ ਵਧੀਆ ਮੌਕਾ ਹੁੰਦਾ ਹੈ ਕਿ ਅਸੀਂ ਸਾਰੇ ਹੀ ਗਲੀ ਦੇ ਯਾਰ ਦੋਸਤ ਸਹੇਲੀਆਂ ਇਕੱਠੇ ਹੁੰਦੇ ਹਾਂ ਆਪਸ ਵਿੱਚ ਗੱਲਾਂ ਬਾਤਾਂ ਵੀ ਕਰ ਲੈਂਦੇ ਹਾਂ ਅਤੇ ਸੋਹਣੀ ਤਰ੍ਹਾਂ ਬੈਠ ਵੀ ਲੈਂਦੇ ਹਾਂ ਚੰਗੇ ਚੰਗੇ ਭੋਜਨਾਂ ਦਾ ਮਜ਼ਾ ਵੀ ਆਉਂਦਾ ਹੈ ਬਰ ਖਾਂਦੇ ਹਾਂ ਗੱਪਾਂ ਮਾਰਦੇ ਹਾਂ ਬੜਾ ਅੱਛਾ ਲੱਗਦਾ ਹੈ ਜਦੋਂ ਅਸੀਂ ਆਪਣੇ ਆਪਣੀਆਂ ਪੁਰਾਣੀਆਂ ਕਈ ਸਹੇਲੀਆਂ ਨੂੰ ਵੀ ਮਿਲ ਲੈਂਦੇ ਹਾਂ ਧੰਨਵਾਦ